ਮੇਰਾ ਪਸੰਦੀਦਾ ਅਭਿਨੇਤਾ ਆਮੀਰ ਖਾਨ ਹੈ ਮੈਨੂੰ ਇਸ ਦੀਆਂ ਸਾਰੀਆਂ ਹੀ ਫਿਲਮਾਂ ਬਹੁਤ ਪਸੰਦ ਆਉਂਦੀਆਂ ਹਨ ਕਿਉਂਕਿ ਆਪਣੇ ਕਿਰਦਾਰ ਨੂੰ ਬਹੁਤ ਖੂਬੀ ਦੇ ਨਾਲ ਨਿਭਾਉਂਦਾ ਹੈ ਬਾਕੀ ਇਸ ਦੀਆਂ ਫਿਲਮਾਂ ਜਿਵੇਂ ਥਰੀ ਇਡੀਅਟ ਗਜਨੀ ਬਹੁਤ ਚੰਗੇ ਤਰੀਕੇ ਨਾਲ ਇਸ ਨੇ ਇਹਦੇ ਵਿੱਚ ਆਪਣਾ ਰੋਲ ਨਿਭਾਇਆ ਹੈ ਔਰ ਅਭਿਨੇਤਰੀ ਦੇ ਵਿੱਚੋਂ ਮੈਨੂੰ ਹੇਮਾ ਮਾਲਨੀ ਪਸੰਦ ਹੈ ਜਿਸ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ